ਬਾਈ ਇੱਕ ਅੱਜ ਕੱਲ੍ਹ ਦੀ ਸਾਡੀ ਰੋਜ਼ ਰੋਜ਼ਮਰ ਜ਼ਿੰਦਗੀ ਦੇ ਵਿੱਚ ਅਹਿਮ ਰੋਲ ਨਿਭਾ ਰਹੀ ਹੈ ਜਦੋਂ ਮੋਟਰਸਾਈਕਲ ਨਹੀਂ ਸੀਗੇ ਇਹ ਅਤੇ ਆਵਾਜਾਈ ਜਿਹੜੀ ਸੀ ਉਹ ਸਾਡੇ ਸਾਈਕਲਾਂ ਦੁਆਰਾ ਬਲਦ ਗੱਡਿਆਂ ਦੁਆਰਾ ਪੁਰਾਣੇ ਸਮਿਆਂ ਦੇ ਵਿੱਚ ਕੀਤੀ ਜਾਂਦੀ ਸੀ ਪਰ ਜਦੋਂ ਦਾ ਵਹੀਕਲ ਵਹੀਕਲ ਲਾਈਨ ਦੇ ਵਿੱਚ ਜਦੋਂ ਦੇ ਮੋਟਰਸਾਈਕਲਾਂ ਦੀ ਕ੍ਰਾਂਤੀ ਆਈ ਹੈ ਮੋਟਰਸਾਇਕਲ ਹਰੇਕ ਘਰ ਦੀ ਜ਼ਰੂਰਤ ਬਣ ਚੁੱਕੇ ਹੈ ਕਿਉਂਕਿ ਇੱਕ ਅਜਿਹਾ ਸਾਧਨ ਹੈ ਜਿਹਦੇ 'ਤੇ ਅਸੀਂ ਆਪਦਾ ਘੰਟਿਆਂ ਦਾ ਸਫਰ ਜਿਹੜਾ ਹੈਗਾ ਉਹ ਮਿੰਟਾਂ 'ਚ ਪੂਰਾ ਕਰਕੇ ਆਪਣੇ ਕੰਮ ਆਪਣੇ ਮੁਕਾਮ ਨੂੰ ਹਾਸਿਲ ਕਰ ਲੈਂਦੇ ਹਾਂ ਰੋਜ਼ਾਨਾ ਰੂਟੀਨ ਦੀ ਜ਼ਿੰਦਗੀ ਦੇ ਵਿੱਚ ਦਫਤਰ ਜਾਣ ਲਈ ਜਾਂ ਕਿਸੇ ਹੋਰ ਘਰੇਲੂ ਕੰਮ ਦੇ ਲਈ ਅਸੀਂ ਮੋਟਰਸਾਈਕਲ ਦੀ ਵਰਤੋਂ ਅਕਸਰ ਹੀ ਕਰਦੇ ਹਾਂ ਮੋਟਰਸਾਈਕਲਾਂ ਨੇ ਅੱਜ ਦੀ ਜ਼ਿੰਦਗੀ ਦੇ ਵਿੱਚ ਅਹਿਮ ਭੂਮਿਕਾ ਬਣਾ ਲਈ ਹੈ ਇਸ ਤੋਂ ਇਲਾਵਾ ਭਾਵ ਜਿਹੜੀ ਸੱਭਿਆਚਾਰ ਦੇ ਬਾਰੇ ਗੱਲ ਕਰੀਏ ਤਾਂ ਭਾਰਤ ਦਾ ਜਿਹੜਾ ਸੱਭਿਆਚਾਰ ਹੈ ਉਹ ਇਹੀ ਕਹਿੰਦਾ ਇਹੀ ਦਰਸਾਉਂਦਾ ਵੀ ਸਾਨੂੰ ਅਸੀਂ ਆਪਣੇ ਜੀਵਨ ਕਾਲ ਦੇ ਵਿੱਚ ਆਪਣੇ ਪਿਛਲੇ ਪਿਛੋਕੜ ਨੂੰ ਯਾਦ ਕਰਦੇ ਹੋਏ ਸਮੇਂ ਦੇ ਸ ਅਕੋਰਡਿੰਗ ਆਪਣੇ ਆਪ ਨੂੰ ਢਾਲਦੇ ਢਾਲਣਾ ਅਤੇ ਨਾਲ ਆਪਣੀ ਜ਼ਿੰਦਗੀ ਨੂੰ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਆਪਣੇ ਹੋਰ ਜੋ ਏਮ ਹੈਗੇ ਆ ਜਾਂ ਇਸ ਦੇ ਨਾਲ ਸੱਭਿਆਚਾਰ ਸੰਬੰਧਿਤ ਗੱਲਾਂ ਬਾਤਾਂ ਹੈਗੀਆਂ ਉਹਨੂੰ ਹੋਰ ਵੀ ਅੱਗੇ ਲੈ ਕੇ ਜਾਣਾ ਹੁੰਦਾ